ਬ੍ਰਹਿਮੰਡ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜਿਹੜੀ ਅਜੇ ਵੀ ਅਨ ਸੁ ਅਣ ਸੁਲਝੀਆਂ ਹਨ ਉਹਨਾਂ ਬਾਰੇ ਹੋਰ ਖੋਜ ਦੀ ਲੋੜ ਹੈ ਜਿਵੇਂ ਕਿ ਬ੍ਰਹਿਮੰਡ ਵਿੱਚ ਅਨੇਕਾਂ ਤਾਰੇ ਹਨ ਅਨੇਕਾਂ ਸੂਰਜ ਹਨ ਪਰ ਉਹ ਕਿਸੇ ਨੇ ਦੇਖੇ ਥੋੜ੍ਹੇ ਹੈ ਉਹ ਸਿਰਫ ਵਿਗਿਆਨਕ ਉਪਕਰਨਾਂ ਨਾਲ ਹੀ ਵਿਗਿਆਨਕ ਤੱਥਾਂ ਨਾਲ ਹੀ ਉਹਦੇ 'ਤੇ ਚਾਨਣਾ ਪਾਇਆ ਜਾਂਦਾ ਹੈ ਅਜੇ ਵੀ ਬ੍ਰਹਿਮੰਡ ਵਿੱਚ ਅਣ ਗਿਣਤ ਅਣ ਸੁਲਝੇ ਤੱਥ ਹਨ ਜਿਨ੍ਹਾਂ 'ਤੇ ਹੋਰ ਖੋਜ ਦੀ ਲੋੜ ਹੈ ਹੋਰ ਖੋਜ ਕਰਨੀ ਬਣਦੀ ਹੈ ਅਤੇ ਹੋਰ ਖੋਜ ਕਰਨੀ ਚਾਹੀਦੀ ਹੈ ਲੋੜੀਂਦੀ ਵੀ ਹੈ